ਨਮਸਤੇ ਜੀ ਨਮਸਤੇ ਜੀ ਮੈਂ ਪਰਮ ਕੁਮਾਰ ਸਡਾਣਾ ਬੋਲ ਰਿਹਾ ਸਾਡੇ ਲੋਹੜੀ ਦਾ ਇੱਕ ਫੰਕਸ਼ਨ ਹੈ ਹਾਂਜੀ ਸਾਡੇ ਬੱਚੇ ਦੀ ਪਹਿਲੀ ਲੋਹੜੀ ਹੈ ਅਤੇ ਅਸੀਂ ਪੰਜਾਹ ਕੁ ਬੰਦਿਆਂ ਵਾਸਤੇ ਮਠਿਆਈ ਬਣਵਾਉਣੀ ਏ ਤੁਹਾਡੀ ਦੁਕਾਨ ਸੁਣਿਆ ਬੜੀ ਮਸ਼ਹੂਰ ਹੈ ਮਠਿਆਈ ਦੀ ਇੱਕ ਤਾਂ ਅਸੀਂ ਬਣਾਉਣੀ ਏ ਖਜੂਰਾਂ ਦੀ ਮਿਠਾਈ ਇੱਕ ਮਤਲਬ ਭੁੱਗਾ ਬਣਾਉਣਾ ਹੈ ਭੁੱਗਾ ਦਾ ਭਾਅ ਕੀ ਹੈ ਅਤੇ ਖਜੂਰਾਂ ਦੀ ਮਿਠਾਈ ਦਾ ਕੀ ਭਾਅ ਹੈ ਇਹਦੇ 'ਚ ਕੀ ਕੀ ਸਮਾਨ ਪਾਉਂਦੇ ਓ ਖੋਇਆ ਵੀ ਪਾਉਂਦੇ ਓ ਮਹਿੰਗੀ ਹੈ ਥੋੜ੍ਹੀ ਜੀ ਮਹਿੰਗੀ ਹੈ ਅਤੇ ਕੁਝ ਨਹੀਂ ਪੰਜਾਹ ਕੁ ਬੰਦਿਆਂ ਦਾ ਲਾ ਲਉ ਹਿਸਾਬ ਵੀ ਪੰਜਾਹ ਡੱਬੇ ਬਣ ਗਏ ਕੀ ਕਿਲੋ ਕਿਲੋ ਆਲੇ ਉਹ ਹੈਂਜੀ ਅਤੇ ਇਹਦੇ 'ਚ ਮਤਲਬ ਵੀ ਅੱਛੀ ਮਠਿਆਈ ਚਾਹੀਦੀ ਹੈ ਸਾਨੂੰ ਕਿਉਂਕਿ ਬੱਚੇ ਦੀ ਪ ਲੋਹੜੀ ਹੈ ਪਹਿਲੀ ਅਤੇ ਬਾਹਰੋਂ ਵੀ ਬੁਲਾਇਆ ਜੇ ਹੋਏ ਸਾਰੇ ਰਿਸ਼ਤੇਦਾਰ ਅਤੇ ਉਹਨਾਂ ਨੂੰ ਵੀ ਦੇਣੀ ਹੈ ਉਹਨਾਂ ਨੂੰ ਵੀ ਖਾਣੀ ਵੀ ਹੈ ਅਤੇ ਕੋਈ ਭਾਅ ਉਹ ਘਟਾਓ ਕੋਈ ਘੱਟ ਜਾਵੇ ਤਾਂ ਹੈਂਜੀ ਹੈਂਜੀ ਚਲੋ ਇਹ ਤਾਂ ਤੁਹਾਡੀ ਬੜੀ ਮਿਹਰਬਾਨੀ ਹੈ ਅਤੇ ਇਹ ਫਿਰ ਤੁਹਾਨੂੰ ਪੈਸੇ ਐਡਵਾਂਸ ਭੇਜੇ ਜਾਣ ਪਹਿਲੇ ਹਾਂਜੀ ਪੈਸੇ ਹਾਂਜੀ ਚਲੋ ਠੀਕ ਹੈ ਜੀ ਮੈਂ ਫਿਰ ਸਲਾਹ ਕਰਕੇ ਅਤੇ ਤੁਹਾਨੂੰ ਫਿਰ ਸਾਰੀ ਗੱਲ ਦੱਸਣਾ ਕਿ ਕਿਉਂਕਿ ਜਾਂ ਮੈਂ ਆਪ ਆਵਾਂਗਾ ਦੁਕਾਨ 'ਤੇ ਤੁਹਾਡੀ ਅਤੇ ਜਾਂ ਮੈਂ ਤੁਹਾਨੂੰ ਟੈ ਟੈਲੀਫੋਨ 'ਤੇ ਲਿਖਾ ਦਿਆਂਗਾ ਸਾਰਾ ਕੁਝ ਆਰਡਰ ਵਗੈਰਾ ਅਤੇ ਮਿਲ ਜਾਣਾ ਚਾਹੀਦਾ ਸਾਨੂੰ ਟਾਈਮ 'ਤੇ ਹੈਂਜੀ ਲੇਟ ਫੇਟ ਨਹੀਂ ਚਾਹੀਦੀ ਬਹਾਨਾ ਵੀ ਨਹੀਂ ਚਾਹੀਦਾ ਸਾਨੂੰ ਵੀ ਅੱਜ ਜਿਹੜਾ ਸਾਡਾ ਕੰਮ ਨਹੀਂ ਹੋਇਆ ਜਾਂ ਮੁਲਾਜ਼ਮ ਨਹੀਂ ਆਏ ਅਤੇ ਇਹਨੂੰ ਬਣਾ ਦਿਓ ਜੇ ਵਧੀਆ ਚਲੋ ਸ਼ੁਕਰੀਆ ਜੀ ਤੁਹਾਡਾ ਬਹੁਤ ਸ਼ੁਕਰੀਆ ਠੀਕ ਹੈ ਠੀਕ ਹੈ ਭਾਜੀ ਠੀਕ ਹੈ